ਹਾਂਜੀ ਜ਼ਿੰਦਗੀ ਵਿੱਚ ਕਲਾ ਦੀ ਬਹੁਤ ਅਹਿਮੀਅਤ ਹੈ ਜਿਵੇਂ ਕਿ ਗਾਣੇ ਗਾਉਣ ਦੀ ਕਲਾ ਡਾਂਸ ਕਰਨ ਦੀ ਕਲਾ ਕੋਈ ਵੀ ਚੀਜ਼ ਨੂੰ ਪੇਂਟ ਕਰਨਾ ਓਹਦੀ ਕਲਾ ਹਰ ਇੱਕ ਕਲਾ ਦੀ ਆਪਣੀ ਆਪਣੀ ਅਹਿਮੀਅਤ ਹੈ ਕਿਉਂਕਿ ਜਿਵੇਂ ਹੁਣ ਆਪਾਂ ਕਹਿੰਦੇ ਹਾਂ ਦੇਖਣ 'ਚ ਕੋਈ ਚੀਜ਼ ਜ਼ਰੂਰੀ ਨਹੀਂ ਕਿ ਛੋਟੀ ਹੋਵੇ ਓਹਦੇ ਵਿੱਚ ਕਲਾ ਦੀ ਅਹਿਮੀਅਤ ਬਹੁਤ ਹੁੰਦੀ ਹੈ ਜਿਵੇਂ ਕਿ ਆਪਾਂ ਹੁਣ ਕਹਿੰਦੇ ਹਾਂ ਲਸਣ ਦੇਖਣ 'ਚ ਤਾਂ ਓਹ ਛੋਟਾ ਜਿਹਾ ਬਟ ਓਹਦੇ ਵਿੱਚ ਕਿੰਨੇ ਗੁਣ ਪਾਏ ਜਾਂਦੇ ਨੇ ਬੜਾ ਗੁਣਕਾਰੀ ਹੈ ਜੋੜਾਂ ਦੇ ਦਰਦ ਠੀਕ ਕਰਦਾ ਕਿਸੇ ਦਾ ਬੀ ਪੀ ਸ਼ੂਗਰ ਹੈ ਓਹ ਕੰਟਰੋਲ ਕਰਦਾ ਜਿਵੇਂ ਹੁਣ ਆਪਾਂ ਗਾਣੇ ਗਾਉਣ ਦੀ ਕਲਾ ਕਹਿ ਦੀਏ ਦੇਖੋ ਜਿਹੜਾ ਬੰਦਾ ਗਾਣਾ ਗਾਉਂਦਾ ਉਹ ਆਪਣੀ ਕਲਾ ਦੇ ਨਾਲ ਕਿੰਨੇ ਬੰਦੇ ਮੋਹਿਤ ਕਰਦ ਲੈਂਦਾ ਓਹ ਆਪਣਾ ਇੰਨਾਂ ਅੱਛਾ ਗਾਉਂਦਾ ਤਾਂ ਲੋਕ ਓਹਨਾਂ ਦੇ ਫੈਨ ਹੋ ਜਾਂਦੇ ਹਨ ਜਿਵੇਂ ਆਪਾਂ ਕੋਈ ਪੇਂਟਿੰਗ ਕਰਦੇ ਹਾਂ ਜੋ ਆਪਾਂ ਇੰਨੀ ਅੱਛੀ ਚੀਜ਼ਾਂ ਪੇਂਟ ਕਰਦੇ ਹਾਂ ਆਪਾਂ ਕਿਸੇ ਨੂੰ ਗਿਫਟ ਕਰਦੇ ਹਾਂ ਕੀ ਹੁੰਦਾ ਓਹਦੇ ਨਾਲ ਕੋਈ ਬੰਦਾ ਆਪਣੀ ਕਲਾ ਤੋਂ ਮੋਹਿਤ ਹੋ ਕੇ ਬਹੁਤ ਖੁਸ਼ ਹੋ ਜਾਂਦਾ ਕਿ ਇਹਨੂੰ ਬਹੁਤ ਅੱਛਾ ਪੇਂਟ ਕਰਨਾ ਆਉਂਦਾ ਹੈ ਇਵੇਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਸਦੀ ਕਲਾ ਬਹੁਤ ਅਹਿਮੀਅਤ ਰੱਖਦੀ ਹੈ ਇਹਦੇ ਨਾਲ ਕੀ ਹੁੰਦਾ ਆਪਣੀ ਮਦਦ ਕਿਵੇਂ ਕਰਦੀ ਹੈ ਇਹਦੇ ਨਾਲ ਜਦੋਂ ਦੇਖੋ ਆਪਾਂ ਕੋਈ ਨਾ ਕੋਈ ਟੈਂਸ਼ਨ 'ਚ ਹੁੰਦੇ ਹਾਂ ਜਿਹੜੀ ਵੀ ਆਪਣੀ ਜਿਸ ਚੀਜ਼ 'ਚ ਆਪਣਾ ਕੋਈ ਇੰਟਰਸਟ ਹੈ ਆਪਣੀ ਕਲਾ ਓਹਦੇ ਨਾਲ ਆਪਣਾ ਸਟਰੈੱਸ ਰੀਲੀਜ਼ ਹੁੰਦਾ ਆਪਣੀ ਮ ਆਪਣੀ ਆਪਾਂ ਆਪਣੀ ਕਲਾ ਨਾਲ ਬਹੁਤ ਕੁਛ ਰਿਲੀਜ਼ ਕਰ ਸਕਦੇ ਹਾਂ ਸ ਮੈਂਟਲੀ ਸਟਰੈੱਸ ਹੁੰਦਾ ਆਪਾਂ ਖੁਸ਼ ਹੋ ਜਾਂਦੇ ਹਾਂ ਆਪਾਂ ਇੰਨਜੋਆਏ ਕਰਦੇ ਹਾਂ ਇਹ ਚੀਜ਼ਾਂ ਕਲਾ ਦੀ ਅਹਿਮੀਅਤ ਨੇ